ਹੈਲੋ ਹਾਂਜੀ ਵੀਰੇ ਫੋਨ ਆਇਆ ਸੀ ਤੁਹਾਡਾ

ਠੀਕ ਹੈ ਠੀਕ ਹੈ ਇੱਕ ਤਾਂ ਤੁਸੀਂ ਸ਼ਿਫਟਿੰਗ ਕਰਨੀ ਹੈ ਅਤੇ ਤੁਸੀਂ ਥੋੜ੍ਹਾ ਵਿਜਿਟ ਕਰਨਾ ਚਾਹੁੰਦੇ ਹੋ ਤੁਸੀਂ ਬਠਿੰਡੇ ਨੂੰ ਹੈਂ ਹਾਂਜੀ ਕੋਈ ਗੱਲ ਨਹੀਂ ਜੀ ਵਿਜ ਸ਼ਿਫਟਿੰਗ ਦਾ ਤਾਂ ਇਹ ਹੈ ਵੀ ਤੁਸੀਂ ਕਿਹੜੇ ਏਰੀਏ 'ਚ ਰਹਿਣਾ ਪਰੈਫਰ ਕਰੋਗੇ ਕਿੱਥੇ ਤੁਹਾਨੂੰ ਮਤਲਬ ਬੱਸ ਸਟੈਂਡ ਦੇ ਨੇੜੇ ਹੋਣਾ ਚਾਹੀਦਾ ਜਾਂ ਰੇਲਵੇ ਸਟੇਸ਼ਨ ਦੇ ਨੇੜੇ ਮੰਗਦੇ ਹੋ ਤੁਸੀਂ ਕੀ ਰਿਕੁਆਇਰਮੈਂਟ ਹੈਗੀ ਤੁਹਾਡੀ ਤਾਂ ਤੁਸੀਂ ਸੀਵੀਲ ਲਾਈਨ 'ਚ ਸੀਵੀਲ ਲਾਈਨ 'ਚ ਲੈ ਲਿਓ ਉੱਥੇ ਠੀਕ ਹੈ ਪੀਸਫੁਲ ਏਰੀਆ ਹੈ ਮੋਡਲ ਟਾਊਨ ਵੀ ਥੋੜ੍ਹਾ ਪੀਸਫੁਲ ਆ ਮੈਂ ਤੁਹਾਨੂੰ ਵਿਜਿਟ ਕਰਾ ਦੂੰਗਾ ਨਾ ਰੇਟ ਠੀਕ ਹੈ ਘੱਟ ਹੀ ਹੈ ਇੰਨਾ ਜ਼ਿਆਦਾ ਨਹੀਂ ਹੋਊਗਾ ਹਾਂਜੀ ਤੁਹਾਨੂੰ ਦਵਾ ਦਾਂਗੇ ਕੋਈ ਜਾਣਕਾਰ ਹੀ ਹੈ ਆਪਣੇ ਡੀਲਰ ਉਹਨਾਂ ਤੋਂ ਅਤੇ ਜਿਹੜਾ ਤੁਸੀਂ ਵਿਜਿਟ ਕਰਨਾ ਹੈ ਲੋਕਲ ਸਿਟੀ ਨੂੰ ਜੇ ਤੁਸੀਂ ਜਿਵੇਂ ਮੋ ਆਪਾਂ ਮਿੱਤਲ ਮੋਲ ਹੈ ਇੱਥੇ ਜਾ ਸਕਦੇ ਜੇ ਮੋਲ ਤੁਸੀਂ ਪ੍ਰੈਫਰ ਕਰਦੇ ਹੋ ਤਾਂ ਅਤੇ ਜੇ ਤੁਹਾਨੂੰ ਨੇਚਰ ਥੋੜ੍ਹਾ ਵਧੀਆ ਲੱਗਦਾ ਤਾਂ ਆਪਾਂ ਇੱਥੇ ਨਹਿਰਾਂ 'ਤੇ ਜਾ ਸਕਦੇ ਹਾਂ ਉੱਥੇ ਜਾ ਕੇ ਵੋਟਿੰਗ ਵਗੈਰਾ ਆਪਾਂ ਕਰ ਸਕਦੇ ਹਾਂ ਅਤੇ ਜੇ ਹਿਸਟੋਰੀਕਲ ਚੀਜ਼ਾਂ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਆਪਾਂ ਕਿਲ੍ਹਾ ਮੁਬਾਰਕ ਜਾ ਸਕਦੇ ਹਾਂ ਜੀ ਉੱਥੇ ਹਿਸਟਰੀ ਜਿਵੇਂ ਹਿਸਟਰੀ ਦੇ ਵਿੱਚੋਂ ਕਿਲ੍ਹਾ ਕਾਫ਼ੀ ਉਹਦਾ ਮਹੱਤਵ ਸੀ ਤਾਂ ਉੱਥੇ ਜਾ ਸਕਦੇ ਹਾਂ ਉਹਦੇ ਇਲਾਵਾ ਜੇ ਤੁਹਾਨੂੰ ਪਾਰਕ ਵਗੈਰਾ ਪਸੰਦ ਹੈ ਤਾਂ ਚੇਤਕ ਪਾਰਕ ਹੈ ਜਿੱਥੇ ਵਾਹਲਾ ਫੇਮਸ ਹੈ ਉੱਥੇ ਆਪਾਂ ਜਾ ਸਕਦੇ ਹਾਂ ਹਾਂਜੀ ਅਤੇ ਸ਼ੋਪਿੰਗ ਜੇ ਤੁਸੀਂ ਕਰਨੀ ਹੈ ਤਾਂ ਵੀ ਤੁਸੀਂ ਜਿਵੇਂ ਜਿਵੇਂ ਤੁਸੀਂ ਸ਼ਿਫਟਿੰਗ ਨਵੀਂ ਕੀਤੀ ਆ ਕੋਈ ਸਮਾਨ ਸਮੂਨ ਤੁਹਾਨੂੰ ਕੱਪੜੇ ਵਗੈਰਾ ਲੈਣੇ ਹੋਣੇ ਕੋਈ ਤਾਂ ਇੱਥੇ ਆਊਟਲੈਟ ਬਣਿਆ ਹੋਇਆ ਜੀ ਇੱਥੇ ਆਪਣੇ ਬਠਿੰਡੇ ਤੋਂ ਬਸ ਦਸ ਕਿਲੋਮੀਟਰ ਬਾਹਰ ਹੈ ਉੱਥੇ ਆਪਾਂ ਜਾ ਸਕਦੇ ਹਾਂ ਜੀ ਓ ਇਹ ਕਈਆਂ ਚੀਜ਼ਾਂ ਦੀ ਲੋਕਲ ਏਰੀਏ ਦੇ ਵਿੱਚ ਵੀ ਜਿਵੇਂ ਕਈ ਵਧੀਆ ਪਾਰਕ ਹੈਗੇ ਦਾਦੀ ਪੋਤੀ ਪਾਰਕ ਹੋ ਗਿਆ ਹੋਰ ਵੀ ਮਾਰਕੀਟ ਬਣੀ ਹੋਈ ਹੈ ਉਹ ਵੀ ਸਾਰੀ ਤੁਹਾਨੂੰ ਵਿਜਿਟ ਕਰਾ ਦੂੰਗਾ ਪਰ ਤੁਹਾਨੂੰ ਪੂਰਾ ਦਿਨ ਫਿਰ ਇੱਕ ਦਿਨ ਫਰੀ ਹੋਣ ਕਰਕੇ ਰੱਖਣਾ ਪਊਗਾ ਆਪਣੇ ਆਪ ਨੂੰ ਟਾਈਮ ਦੇਣਾ ਪਊਗਾ ਸੈਟਡੇ ਸਨਡੇ ਔਫ ਹੁੰਦਾ ਨਾ ਤੁਹਾਡਾ ਹਾਂ ਹਾਂ ਤੋ ਸੰਡੇ ਨੂੰ ਮੈਂ ਮੈਨੂੰ ਫੋਨ ਕਰਲਿਓ ਤੁਸੀਂ ਮੈ ਤੁਹਾਨੂੰ ਸਾਰੀਆਂ ਥਾਂ 'ਤੇ ਜਾਂ ਘੁੰਮਾ ਦੂੰਗਾ ਅਤੇ ਜੇ ਤੁਸੀਂ ਅ ਨਵਾਂ ਵਾਟਰ ਪਾਰਕ ਵੀ ਹੁਣੇ ਖੁਲਿਆ ਜੇ ਉੱਥੇ ਜਾਣਾ ਉੱਥੇ ਵੀ ਆਪਾ ਜਾ ਵੜਾਂਗੇ ਦੱਸ ਦਿਓ ਤੁਸੀਂ ਹਾਂਜੀ ਅਤੇ ਬਾਕੀ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀ ਆ ਉਹ ਤੁਸੀਂ ਇੱਕ ਵਾਰ ਗੂਗਲ ਕਰਕੇ ਜਾਂ ਯੂਟੀਊਬ 'ਤੇ ਵੀ ਦੇਖ ਲਿਓ ਜਿਹੜੀ ਤੁਹਾਡੀ ਮਤਲਬ ਤੁਹਾਨੂੰ ਜਿਹੜਾ ਜੀ ਕਰੂਗਾ ਤੁਹਾਨੂੰ ਤੁਹਾਡਾ ਉੱਥੇ ਆਪਾਂ ਬਣਾ ਲਾਂਗੇ ਪ੍ਰੋਗਰਾਮ ਠੀਕ ਹੈ ਠੀਕ ਓਕੇ ਜੀ ਓਕੇ